ਅੰਗਰੇਜ਼ਾਂ ਦੇ ਜਾਣ ਤੋਂ ਤੁਰੰਤ ਬਾਅਦ ਦੇ ਸਮੇਂ ਵਿੱਚ ਪੰਜਾਬ ਵਿੱਚ ਪ੍ਰਵਾਸ ਦੀ ਉਨੀ ਸੌ ਸੰਤਾਲੀ ਦੀ ਵੰਡ ਬਹੁਤ ਜ਼ਿਆਦਾ ਕੇਂਦਰਿਤ ਸੀ ਜਦੋਂ ਕਿ ਅਗਸਤ ਤੋਂ ਦਸੰਬਰ ਉਨੀ ਸੌ ਸੰਤਾਲੀ ਦਰਮਿਆਨ ਅੱਸੀ ਲੱਖ ਤੋਂ ਵੱਧ ਪੰਜਾਬੀਆਂ ਨੂੰ ਉਜਾੜ ਦਿੱਤਾ ਗਿਆ ਸੀ ਇਸ ਸਮੇਂ ਬੰਗਾਲ ਵਿੱਚ ਸ਼ਰਨਾਰਥੀਆਂ ਦੀ ਕੁੱਲ ਗਿਣਤੀ ਸਿਰਫ ਪੰਜ ਲੱਖ ਦੇ ਕਰੀਬ ਸੀ ਉਨੀ ਸੌ ਸੰਤਾਲੀ ਦੇ ਕਤਲੇਆਮ ਅਤੇ ਪਰਵਾਸ ਕਈ ਸਾਲਾਂ ਲਈ ਬਹੁਤ ਘੱਟ ਸਨ ਭਾਰਤ ਦੀ ਪ੍ਰਾਪਤੀ ਦੇ ਅਧਿਐਨ ਵਿੱਚ ਫੁੱਟਨੋਟ ਤੋਂ ਵੱਧ ਅਤੇ ਪਾਕਿਸਤਾਨ ਦੀ ਆਜ਼ਾਦੀ ਸਮੁੱਚੇ ਤੌਰ 'ਤੇ ਵੰਡ ਦੁਆਰਾ ਉਤਪ੍ਰੇਰਿਤ ਸਮੂਹਿਕ ਪ੍ਰਵਾਸ ਪੰਜਾਬ ਖੇਤਰ ਲਈ ਇੱਕ ਦੁੱਖਦਾਈ ਅਸਥਿਰ ਘਟਨਾ ਸੀ ਜਿਸ ਨਾਲ ਉੱਨੀ ਸੌ ਚਾਲੀ ਦੇ ਦਹਾਕੇ ਦੇ ਅਖੀਰ ਵਿੱਚ ਬਹੁਤ ਵੱਡੀ ਮਾਨਵਤਾਵਾਦੀ ਆਰਥਿਕ ਅਤੇ ਸਮਾਜਿਕ ਰਾਜਨੀਤਿਕ ਉਥਲ ਪੁਥਲ ਹੋਈ ਮੇਰੇ ਦਾਦਾ ਦਾਦੀ ਨੇ ਦੱਸਿਆ ਕਿ ਇਹ ਉਹਨਾਂ ਦੇ ਜੀਵਨ ਕਾਲ ਦੀ ਸਭ ਤੋਂ ਦਰਦਨਾਕ ਅਤੇ ਭਿਆਨਕ ਘਟਨਾ ਸੀ ਮੇਰੀ ਦਾਦੀ ਸਤਾਸੀ ਸਾਲਾਂ ਦੀ ਹੈ ਉਸਨੂੰ ਅਜੇ ਵੀ ਉਸਦੀ ਗਲੀ ਲਾਹੌਰ ਵਿੱਚ ਇੱਕ ਹਿੰਦੂ ਇਲਾਕੇ ਨੂੰ ਅੱਗ ਲੱਗਣ ਦੇ ਸੁਪਨੇ ਆਉਂਦੇ ਹਨ ਮੇਰੇ ਦਾਦਾ ਜੀ ਨੂੰ ਆਪਣੇ ਸਭ ਤੋਂ ਚੰਗੇ ਦੋਸਤ ਨਾਲ ਵੱਖ ਹੋਣਾ ਪਿਆ ਸੀ ਉਹ ਇੰਨੇ ਨੇੜੇ ਸਨ ਕਿ ਉਹਨਾਂ ਨੇ ਆਪਣੇ ਖੱਬੇ ਬਾਈਸੈਪਸ 'ਤੇ ਇੱਕ ਦੂਜੇ ਦੇ ਸ਼ੁਰੂਆਤੀ ਚਿੰਨ੍ਹ ਦੇ ਟੈਟੂ ਬਣਾਏ ਹੋਏ ਸਨ ਵੰਡ ਤੋਂ ਬਾਅਦ ਮਿਲਦੇ ਹਨ ਅਤੇ ਸਮਾਂ ਜਾਂ ਸੱਟਾਂ ਉਹਨਾਂ ਦੇ ਚਿਹਰੇ ਖੈਰ ਮੇਰੇ ਦਾਦਾ ਜੀ ਦੀ ਮੌਤ ਐਵੇਂ ਦੀ ਬਾਂਹ 'ਤੇ ਟੈਟੂ ਨਾਲ ਹੋਈ ਸੀ ਮੈਂ ਉਮੀਦ ਕਰਦਾ ਹਾਂ ਕਿ ਪਾਕਿਸਤਾਨ ਵਿੱਚ ਕਿਤੇ ਨਾ ਕਿਤੇ ਐਸ ਕੇ ਉਸਦੀ ਬਾਂਹ 'ਤੇ ਬਣਿਆ ਟੈਟੂ ਅਜੇ ਵੀ ਜ਼ਿੰਦਾ ਹੈ ਇੱਥੇ ਆ ਕੇ ਉਹਨਾਂ ਨੇ ਜਾਨ ਅੰਗ ਅਤੇ ਜਾਇਦਾਦ ਗਵਾਈ ਮੇਰੇ ਨਾਨਕਿਆਂ ਵਿੱਚੋਂ ਇੱਕ ਨੇ ਦੰਗਿਆਂ ਵਿੱਚ ਆਪਣੀ ਸੱਜੀ ਬਾਂਹ ਗਵਾ ਦਿੱਤੀ ਅਤੇ ਸਾਨੂੰ ਦੋ ਹੱਥ ਲਿਖਤਾਂ ਵਿੱਚ ਲਿਖੀਆਂ ਚਿੱਠੀਆਂ ਵਿਰਾਸਤ ਵਿੱਚ ਮਿਲੀਆਂ ਇੱਕ ਸੱਜੇ ਹੱਥ ਤੂੰ ਵੰਡ ਤੋਂ ਪਹਿਲਾਂ ਅਤੇ ਇੱਕ ਖੱਬੇ ਹੱਥ ਤੋਂ ਵੰਡ ਤੋਂ ਬਾਅਦ ਇੱਕ ਉਦਾਸ ਗੰਭੀਰ ਯਾਦ ਵਜੋਂ ਮੇਰੀ ਪਰਿਵਾਰ ਵਿੱਚ ਕਹਾਣੀਆਂ ਬਹੁਤ ਜ਼ਿਆਦਾ ਚੱਲਦੀਆਂ ਹਨ ਮੈਂ ਉਹਨਾਂ ਵਿੱਚੋਂ ਅੱਧੀਆਂ ਨੂੰ ਵੀ ਨਹੀਂ ਜਾਣਦਾ ਪਰ ਜੋ ਮੈਂ ਜਾਣਦਾ ਹਾਂ ਉਹ ਇਹ ਹੈ ਕਿ ਲਾਹੌਰ ਕਦੇ ਮੇਰੇ ਪਰਿਵਾਰ ਲਈ ਇੱਕ ਸੁੰਦਰ ਘਰ ਸੀ ਕਿ ਇਸ ਵਰਗੀ ਕੋਈ ਥਾਂ ਨਹੀਂ ਹੈ ਅਸਲ ਵਿੱਚ ਅਤੇ ਇਹ ਕਿ ਮੇਰੇ ਵਰਗੇ ਹਜ਼ਾਰਾਂ ਪਰਿਵਾਰਾਂ ਨੂੰ ਵਰਣਨਯੋਗ ਸਦਮੇ ਦਾ ਸਾਹਮਣਾ ਕਰਨਾ ਪਿਆ